ਪੀ ਟੀ ਊਸ਼ਾ ਇੱਕ ਉੱਘੀ ਭਾਰਤੀ ਐਥਲੀਟ ਹੈ ਅਤੇ ਉੱਨੀ ਸੌ ਉਣਾਸੀ ਤੋਂ ਲੈ ਕੇ ਉਹ ਭਾਰਤੀ ਐਥਲੈਟੀਕਸ ਦੇ ਨਾਲ ਜੁੜੀ ਹੋਈ ਹੈ ਹੁਣ ਉਹ ਰਿਟਾਇਰਡ ਭਾਰਤੀ ਟਰੈਕ ਅਤੇ ਫੀਲਡ ਔਫੀਸਰ ਕਰਕੇ ਜਾਣੀ ਜਾਂਦੀ ਹੈ ਅਤੇ ਉਹਨੇ ਚਾਰ ਵਾਰ ਏਸ਼ੀਅਨ ਗੋਲਡ ਮੈਡਲ ਜਿੱਤੇ ਹੈ ਸੱਤ ਸਿਲਵਰ ਮੈਡਲ ਜਿੱਤੇ ਹੈ ਅਤੇ ਉਹਨੂੰ ਕਿਹਾ ਜਾਂਦਾ ਹੈ ਭਾਰਤੀ ਟਰੈਕ ਦੀ ਰਾਣੀ ਭਾਰਤੀ ਕੁੜੀਆਂ ਲਈ ਬਹੁਤ ਹੀ ਪ੍ਰੇਰਨਾ ਸਰੋਤ ਹੈ ਬਹੁਤ ਹੀ ਹਿੰਮਤ ਵਾਲੀ ਜਜ਼ਬੇ ਵਾਲੀ ਉਹ ਭਾਰਤ ਦੀ ਬੇਟੀ ਅੱਜ ਉਸ ਨੇ ਭਾਰਤ ਦਾ ਨਾਂ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਚਮਕਾਇਆ